ਸਰ ਦਿਲਪ੍ਰੀਤ ਬੋਲਦਾ ਜੀ ਫੋਟੋ ਸ਼ੂਟ ਕਰਾਉਣਾ ਸੀ ਹਾਂਜੀ ਫੋਟੋਸ਼ੂਟ ਆਪਾਂ ਨੂੰ ਦੋ ਤਿੰਨ ਦਿਨ ਤੱਕ ਚਾਹੀਦਾ ਜੀ ਮੇਰੇ ਭਰਾ ਦਾ ਵਿਆਹ ਦਾ ਜੀ ਇਹ ਆਪਾਂ ਮੈਰਿਜ ਜੇਕਰ ਮੈਰਿਜ ਦੀ ਫੋਟੋਸ਼ੂਟ ਕਰਦੇ ਹਾਂ ਅਤੇ ਰਿਸੈਪਸ਼ਨ ਮਹਿੰਦੀ ਦੀ ਰਸਮ ਇਹ ਤਿੰਨੇ ਕਰਦੇ ਹਾਂ ਜੀ ਹਾਂਜੀ ਹਾਂਜੀ ਦੋ ਤਿੰਨ ਦਿਨ ਵਿੱਚ ਵਿੱਚ ਹਾਂਜੀ ਪਰੀ ਵੈਡਿੰਗ ਦਾ ਟਾਈਮ ਤਾਂ ਨਹੀਂ ਸਰ ਚਲੋ ਵੇਖ ਲੈਂਦੇ ਆ ਸਰ ਜੇ ਟਾਈਮ ਹੋਇਆ ਤਾ ਕਰਵਾ ਦਾਂਗੇ ਪਰੀ ਵੈਡਿੰਗ ਅਤੇ ਆਪਣਾ ਮਤਲਬ ਪੈਕਜ ਕਿੰਨਾ ਕੁ ਏ ਪਰ ਜ਼ਿਆਦਾ ਨਹੀਂ ਲੱਖ ਰੁਪਏ ਤੱਕ ਤਾਂ ਮੈਂ ਦੇ ਸਕਦਾ ਜੀ ਹਾਂਜੀ ਸਰ ਠੀਕ ਹੈ ਸਰ ਅਤੇ ਆਪਣੇ ਕੋਲੇ ਪਹਿਲਾਂ ਵੀ ਐਲਬਮ ਬਣੀਆਂ ਹੋਈਆਂ ਵਾ ਦੇਖ ਸਕਦੇ ਹਾਂ ਅਸੀਂ ਕੋਈ

ਹਾਂਜੀ ਠੀਕ ਹੈ ਸਰ ਓਕੇ ਓਕੇ ਸਰ